ਮੈਂ ਇੱਕ ਬੁੱਕ ਪੜ੍ਹੀ ਸੀ ਜਿਹਦਾ ਨਾਮ ਹੈਗਾ ਸੀ ਦਾ ਬਰਾਈਟ ਪਲੇਸਿਸ ਇਹ ਇੱਕ ਕਹਾਣੀ ਵਾਲੀ ਬੁੱਕ ਸੀ ਜਿਹਦੇ ਵਿੱਚ ਇੱਕ ਕਹਾਣੀ ਨੋਵਲ ਵਾਂਗੂ ਲਿਖੀ ਹੋਈ ਸੀ ਅਤੇ ਇਹ ਜਿਹੜੀ ਹੈਗੀ ਸੱਚੀ ਘਟਨਾ ਦੇ ਅਧਾਰਿਤ ਨਹੀਂ ਸੀ ਅਤੇ ਔਥਰ ਨੇ ਜਿਹੜੀ ਹੈਗੀਹੈ ਕਹਾਣੀ ਬੜੀ ਚੰਗੇ ਤਰੀਕੇ ਨਾਲ ਬਿਆਨ ਕੀਤੀ ਹੋਈ ਸੀ ਕਿ ਕੀ ਕੀ ਹੁੰਦਾ ਉਹਦੇ ਵਿੱਚ ਅਤੇ ਇਹ ਜਿਹੜੀ ਬੁੱਕ ਹੈ ਇਹ ਜਿਹੜੀ ਕਹਾਣੀ ਹੈ ਮੈਨੂੰ ਲੱਗਦੀ ਹੈ ਕਿ ਮੈਨੂੰ ਬਹੁਤ ਜ਼ਿਆਦਾ ਸੋਚਣ 'ਤੇ ਮਜਬੂਰ ਕੀਤਾ ਇਸ ਕਹਾਣੀ ਨੇ ਕਿਉਂਕਿ ਇਹਦੇ ਵਿੱਚ ਕਈ ਤਰ੍ਹਾਂ ਦੇ ਇੰਸੀਡੈਂਟ ਇੱਦਾਂ ਦੇ ਸੀ ਜਿਹੜੇ ਕਿ ਸਿੱਧਾ ਹੀ ਮੇਰੀ ਲਾਈਫ ਦੇ ਵਿੱਚ ਲੱਗਦੇ ਸੀ ਮੈਨੂੰ ਕਿ ਹੋਏ ਨੇ ਜਾਂ ਫਿਰ ਹੋਣਗੇ ਅੱਗੇ ਜਾ ਕੇ ਅਤੇ ਇਸ ਕਹਾਣੀ ਨੇ ਮੈਨੂੰ ਬਹੁਤ ਕੁਛ ਸਿਖਾਇਆ ਜ਼ਿੰਦਗੀ ਦੇ ਲੈਸਨਸ ਬਾਰੇ ਇਹ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਇੱਕ ਕੁੜੀ ਤੋਂ ਜਿਹੜੀ ਕਿ ਆਪਣੇ ਆਪ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਆਤਮ ਹੱਤਿਆ ਕਰਨਾ ਚਾਹੁੰਦੀ ਹੈ ਪਰ ਉਹ ਮੁੰਡਾ ਜਿਹੜਾ ਹੈਗਾ ਉਹਨੂੰ ਬਚਾ ਲੈਂਦਾ ਅਤੇ ਉਸ ਤੋਂ ਬਾਅਦ ਮੁੰਡਾ ਅ ਉਹਦੇ ਨਾਲ ਰਹਿੰਦਾ ਉਹਦੇ ਨਾਲ ਟਾਈਮ ਸਪੈਂਡ ਕਰਦਾ ਅਤੇ ਉਹਨੂੰ ਦੱਸਦਾ ਕਿ ਕਿਵੇਂ ਜ਼ਿੰਦਗੀ ਦੇ ਅਰਥ ਜਿਹੜੇ ਹੈਗੇ ਨੇ ਬਹੁਤ ਹੀ ਡੂੰਘੇ ਹੁੰਦੇ ਨੇ ਅਤੇ ਕਿਵੇਂ ਅਸੀਂ ਆਪਣੀ ਜ਼ਿੰਦਗੀ ਨੂੰ ਚੰਗੇ ਤਰੀਕੇ ਨਾਲ ਜੀ ਸਕਦੇ ਹਾਂ ਖੁਸ਼ੀ ਖੁਸ਼ੀ ਜੀ ਸਕਦੇ ਹਾਂ ਅਤੇ ਪਰ ਅੰਤ ਦੇ ਵਿੱਚ ਉਹ ਮੁੰਡਾ ਹੀ ਆਪਣੇ ਆਪ ਹੀ ਆਤਮ ਹੱਤਿਆ ਕਰ ਲੈਂਦਾ ਅਤੇ ਉਸ ਲਈ ਮੈਂ ਸ ਪਹਿਲੀ ਗੱਲ ਤਾਂ ਮੈਨੂੰ ਸੋਚਣ 'ਤੇ ਜੋ ਮਜਬੂਰ ਕੀਤੀ ਕਿ ਜਿਸ ਮੁੰਡੇ ਨੇ ਉਸ ਕੁੜੀ ਨੂੰ ਸਿਖਾਇਆ ਕਿ ਜ਼ਿੰਦਗੀ ਦੇ ਅਰਥ ਕੀ ਹੁੰਦੇ ਨੇ ਉਹ ਖੁਦ ਹੀ ਚਲਾ ਗਿਆ ਉਸਨੇ ਖੁਦ ਹੀ ਜਿਹੜੀ ਹੈਗੀ ਆਤਮ ਹੱਤਿਆ ਕਰ ਲਈ ਤਾਂ ਮੈਨੂੰ ਲੱਗਦਾ ਹੈ ਕਿ ਇਹ ਅਗਰ ਮੈਂ ਰਿਲੇਟ ਕਰਾਂ ਆਪਣੀ ਜ਼ਿੰਦਗੀ ਤੋਂ ਮੈਨੂੰ ਲੱਗਦਾ ਕਿ ਇੱਥੇ ਕਦੇ ਕਦੇ ਆਪਾਂ ਦੂਜਿਆਂ ਦੀ ਖੁਸ਼ੀ ਦਾ ਕਾਰਨ ਜ਼ਰੂਰ ਬਣ ਜਾਂਦੇ ਹਾਂ ਪਰ ਲੇਕਿਨ ਆਪਣੀ ਖੁਸ਼ੀ ਦਾ ਕਾਰਨ ਬਣਨਾ ਆਪਾਂ ਭੁੱਲ ਜਾਂਦੇ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਇਹ ਮੇਰੀ ਜ਼ਿੰਦਗੀ ਨਾਲ ਰਿਲੇਟ ਕਰਕੇ ਮੈਂ ਸੋਚਿਆ ਸੀ ਅਤੇ ਇੱਥੇ ਇਸ ਸਟੋਰੀ ਦੇ ਵਿੱਚ ਕਈ ਤਰ੍ਹਾਂ ਦੀਆਂ ਇੱਦਾਂ ਦੇ ਇੰਸੀਡੈਂਟ ਮੈਂਸ਼ਨ ਨੇ ਜਿਹੜੇ ਕਿ ਮੇਰੀ ਜ਼ਿੰਦਗੀ ਨੂੰ ਇੱਕ ਦੇਖਣ ਦਾ ਜਦੋਂ ਜ਼ਰੀਆ ਮੇਰਾ ਉਹਨੇ ਬਦਲਿਆ ਅਤੇ ਅ ਕਈ ਤਰ੍ਹਾਂ ਜਿਹੜੇ ਇੰਸੀਡੈਂਟ ਨੇ ਜੋ ਮੇਰੇ ਡਰੈਕਟਲੀ ਮੇਰੇ ਜ਼ਿੰਦਗੀ ਨਾਲ ਰਿਲੇਟ ਕੀਤੇ ਨੇ ਇਸ ਕਹਾਣੀ ਦੇ ਅਤੇ ਇਸ ਲਈ ਮੈਨੂੰ ਲੱਗਦਾ ਕਿ ਇਹ ਕਹਾਣੀ ਜਿਹੜੀ ਹੈਗੀ ਹੈ ਇੱਦਾਂ ਦੀ ਸੀ ਜਿਹਨੇ ਮੈਨੂੰ ਸੋਚਣ 'ਤੇ ਉਕਸਾਉਣ 'ਤੇ ਬਹੁਤ ਹੀ ਮਜਬੂਰ ਕੀਤਾ ਅਤੇ ਅ ਅਸੀਂ ਜਿਹੜੀ ਹੈਗੀ ਨਵੀਂ ਨਵੀਂ ਕਹਾਣੀਆਂ ਪੜ੍ਹਨ ਲਈ ਇੱਕ ਰੀਡਿੰਗ ਕਲੱਬ ਦੇ ਵਿੱਚ ਵੀ ਮੈਂ ਜੁੜੀ ਹੋਈ ਹਾਂ ਜਿੱਥੇ ਜਿਹੜੀ ਹੈਗੀ ਜੇ ਕੋਈ ਅਗਰ ਨਵੀਂ ਬੁੱਕ ਵਧੀਆ ਜਿਹੜੀ ਹੁੰਦੀ ਆ ਪਬਲਿਸ਼ ਹੁੰਦੀ ਹੈ ਤਾਂ ਜਿਹੜੇ ਮੈਂਬਰਸ ਨੇ ਉਹ ਜਿਹੜੀ ਬੁੱਕਸ ਨੇ ਉਹ ਲੈ ਕੇ ਆਉਂਦੇ ਨੇ ਅਤੇ ਇੱਕ ਦੂਜੇ ਨਾਲ ਸ਼ੇਅਰ ਕਰਦੇ ਨੇ ਅਸੀਂ ਇੱਕ ਦੂਜੇ ਨਾਲ ਡਿਸਕਸ ਵੀ ਕਰਦੇ ਹਾਂ ਜੋ ਅਸੀਂ ਪੜ੍ਹਦੇ ਹਾਂ ਤਾਂ ਕਿ ਜਿਹੜੇ ਰੀਡਿੰਗ ਇਕੱਲੀ ਰੀਡਿੰਗ ਹੀ ਨਾ ਰਹਿ ਜੇ ਉਹਦੇ ਨਾਲ ਨਾਲ ਅਸੀਂ ਆਪਣੇ ਜ਼ਿੰਦਗੀ ਨਾਲ ਰਿਲੇਟ ਕਰੀਏ ਅਤੇ ਉਹ ਤੋਂ ਕੁਛ ਸਿੱਖੀਏ ਅਤੇ ਇਸ ਲਈ ਮੈਂ ਇੱਕ ਰੀਡਿੰਗ ਕਲੱਬ ਦੇ ਵਿੱਚ ਵੀ ਜੁੜੀ ਹੋ ਕੇ ਦੂਜਿਆਂ ਨਾਲ ਵੀ ਅਸੀਂ ਹੈਲਪ ਕਰਦੇ ਹਾਂ ਕਦੇ ਕਦੇ ਅਸੀਂ ਜਿਹੜੀ ਰੀਡਿੰਗ ਕਲੱਬ ਦੇ ਜਿਹੜੇ ਮੈਂਬਰ ਨਹੀਂ ਹੈ ਉਹਨਾਂ ਨਾਲ ਵੀ ਅਸੀਂ ਸ਼ੇਅਰ ਕਰਦੇ ਹਾਂ ਕਿ ਅਸੀਂ ਇੱਦਾਂ ਦੇ ਕਲੱਬ ਵਿੱਚ ਸ਼ਾਮਲ ਹਾਂ ਤੁਸੀਂ ਆ ਸਕਦੇ ਹੋ ਅਤੇ ਅਸੀਂ ਉਹਨਾਂ ਨਾਲ ਵੀ ਆਪਣੇ ਜਿਹੜੇ ਹੈਗੇ ਆ ਸਾ ਉਹ ਨੇ ਆਈਡੀਆਜ ਨੇ ਉਹਨਾਂ ਨੂੰ ਸ਼ੇਅਰ ਕਰਦੇ ਹਾਂ ਸਾਂਝੇ ਕਰਦੇ ਹਾਂ ਉਹਨਾਂ ਨਾਲ ਵੀ ਅਤੇ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਬੁੱਕ ਆ ਮੈਂ ਉੱਥੇ ਵੀ ਪੜ੍ਹੀ ਸੀ ਅਤੇ ਮੈਨੂੰ ਬੜੀ ਚੰਗੀ ਲੱਗੀ ਅਤੇ ਮੈਨੂੰ ਲੱਗਦਾ ਕਿ ਇਹ ਬੁੱਕ ਹੁਣ ਵੀ ਜਿਹੜੀ ਹੈਗੀ ਹੈ ਮੇਰੇ ਦਿਲ 'ਚ ਵਸੀ ਹੋਈ ਹੈ ਅਤੇ ਮੈਂ ਹੁਣ ਵੀ ਜਿਹੜੇ ਹੈਗੇ ਆ ਕਈ ਇੱਦਾਂ ਦੀ ਇੰਸੀਡੈਂਟ ਨੇ ਜਿਹਦੇ ਨਾਲ ਮੈਂ ਸੋਚਦੀ ਹਾਂ ਕਿ ਇਹ ਜਿਹੜਾ ਹੈਗਾ ਮੇਰੀ ਜ਼ਿੰਦਗੀ ਦੇ ਵਿੱਚ ਕਿਵੇਂ ਸਹਾਇਕ ਹੋ ਸਕਦੇ ਨੇ ਕੁਸ ਕਿਸੇ ਡਿਸੀਜ਼ਨ ਨੂੰ ਲੈਣ ਲਈ ਅਤੇ ਹੁਣ ਵੀ ਅਗਰ ਮੇਰਾ ਦਿਲ ਕਰਦਾ ਉਸ ਬੁੱਕ ਨੂੰ ਪੜ੍ਹਨ ਦਾ ਤਾਂ ਮੈਂ ਵਾਰ ਵਾਰ ਪੜ੍ਹਦੀ ਹਾਂ